ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਐਨ ਜੀ ਓ ਤੋਂ ਬੋਲ ਰਿਹਾ ਜੀ ਠੀਕ ਠਾਕ ਹੋ ਕੀ ਹਾਲ ਚਾਲ ਤੁਹਾਡੇ ਪਿੰਡ ਦਾ ਜੀ ਸਾਡੇ ਐਨ ਜੀ ਓ ਦੀ ਇਸ ਤਰ੍ਹਾਂ ਦੀ ਪਲੈਨਿੰਗ ਚੱਲ ਰਹੀ ਸੀਗੀ ਵੀ ਅਸੀਂ ਚਾਹੁੰਦੇ ਸੀ ਵੀ ਤੁਹਾਡੇ ਪਿੰਡ ਦੇ ਵਿੱਚ ਮਤਲਬ ਐਨ ਜੀ ਓ ਵੱਲੋਂ ਕੁਝ ਸਰਗਰਮੀਆਂ ਕੀਤੀਆਂ ਜਾਣ ਅਤੇ ਉਹ ਸਰਗਰਮੀਆਂ ਦੇ ਵਿੱਚ ਅਸੀਂ ਕਾਫ਼ੀ ਸਾਰੇ ਜਿਹੜੇ ਮੁੱਦਿਆਂ ਨੂੰ ਛੂਹਣ ਛੂਹਣ ਦੀ ਕੋਸ਼ਿਸ਼ ਕੀਤੀ ਅੱਜ ਪੰਜਾਬ ਹੈ ਜਿਹੜਾ ਉਹ ਦੋ ਤਿੰਨ ਤਰ੍ਹਾਂ ਦੀ ਸਮੱਸਿਆ ਦੇ ਨਾਲ ਵੱਡੀ ਪੱਧਰ ਦੇ ਉੱਤੇ ਜੂਝ ਰਿਹਾ ਹੈਗਾ ਜਿਵੇਂ ਇੱਕ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈਗੀ ਹੈ ਅੱਜ ਦਰੱਖਤਾਂ ਦੀ ਬਹੁਤ ਵੱਡੀ ਘਾਟ ਹੈ ਸਰਕਾਰ ਦੀਆਂ ਨਕਾਮੀਆਂ ਕਰਕੇ ਕਹਿ ਲਓ ਜਾਂ ਇਹ ਕਹਿ ਲਓ ਵੀ ਮਤਲਬ ਹਾਲਾਤ ਕਰਕੇ ਲੋਕ ਅੱਗਾਂ ਵਾਲੇ ਪਾਸੇ ਬਹੁਤ ਜ਼ਿਆਦਾ ਵਧੇ ਹੋਏ ਆ ਹੈ ਨਾ ਝੋਨੇ ਦੀ ਪਰਾਲੀ ਨੂੰ ਲੋਕ ਪਹਿਲਾਂ ਅੱਗ ਲਗਾਉਂਦੇ ਸੀਗੇ ਅੱਜ ਕੱਲ੍ਹ ਉਹ ਦੂਸਰੇ ਪਾਸੇ ਵੀ ਹੋਏ ਹੋਏ ਆ ਮਤਲਬ ਕਣਕ ਦੇ ਉਹਨੂੰ ਵੀ ਲਾ ਰਹੇ ਆ ਤਾਂ ਦਰੱਖਤਾਂ ਦਾ ਵੀ ਨੁਕਸਾਨ ਬਹੁਤ ਵੱਡਾ ਹੋ ਰਿਹਾ ਹੈ ਇੱਕ ਤਾਂ ਸਾਡਾ ਇਹ ਸੀ ਵੀ ਤੁਸੀਂ ਸਾਨੂੰ ਸਹਿਯੋਗ ਕਰੋ ਅਤੇ ਅਸੀਂ ਤੁਹਾਡੇ ਪਿੰਡ 'ਚ ਦਰੱਖਤਾਂ ਨੂੰ ਲਗਾਉਣ ਦੇ ਉੱਤੇ ਕੰਮ ਕਰੀਏ ਅਤੇ ਅੱਜ ਬਹੁਤ ਸਾਰੀ ਲੋੜ ਹੈ ਕਿਉਂਕਿ ਪਹਿਲਾਂ ਪਿੰਡਾਂ ਦੇ ਵਿੱਚ ਆਪਣੇ ਬਹੁਤ ਦਰੱਖਤ ਹੁੰਦੇ ਸੀ ਅਤੇ ਪੰਚਾਇਤਾਂ ਵੀ ਇਹ ਕੰਮ ਕਰਦੀਆਂ ਸੀ ਅੱਜ ਜਿਹੜਾ ਸਿਆਸੀ ਤਾਣਾ ਬਾਣਾ ਉਸ ਤਰ੍ਹਾਂ ਦਾ ਹੈਗਾ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਮਤਲਬ ਵਧੀਆ ਕੰਮਾਂ ਦੀ ਬਜਾਏ ਹੋਰ ਪੁੱਠੇ ਸਿੱਧੇ ਕੰਮਾਂ ਵਾਲੇ ਪਾਸੇ ਲਾ ਕੇ ਟਾਈਮ ਵੇਸਟ ਕੀਤਾ ਜਾ ਰਿਹਾ ਅਤੇ ਆਪਾਂ ਐਨ ਜੀ ਓ ਵੱਲੋਂ ਇਹ ਸੋਚਿਆ ਵੀ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਦਰੱਖਤਾਂ ਦਾ ਇੱਥੇ ਜਿਹੜਾ ਵਧੀਆ ਤਾਣਾ ਬਾਣਾ ਉਹ ਬੁਣੀਏ ਹਰ ਗਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਸੱਥਾਂ ਦੇ ਵਿੱਚ ਪਿੱਪਲ ਬੋਹੜ ਵਰਗੀਆਂ ਘਣੀਆਂ ਛਾਵਾਂ ਹੋਣ ਹੈ ਨਾ ਅਤੇ ਕਿਵੇਂ ਲੱਗ ਰਿਹਾ ਤੁਹਾਨੂੰ ਜੀ ਜੀ ਜੀ ਜੀ ਜੀ ਜੀ ਜੀ ਜੀ ਦੂਸਰਾ ਜਿਹੜਾ ਮੁੱਦਾ ਨਾ ਜੀ ਉਹ ਇੱਕ ਜੀ ਜੀ ਥੈਂਕ ਯੂ ਅਤੇ ਦੂਜੀ ਗੱਲ ਇਹ ਹੈ ਜੀ ਵੀ ਆਪਾਂ ਜਿਹੜਾ ਮਤਲਬ ਇਹ ਜਿਹੜੇ ਦਰੱਖਤ ਲਾਵਾਂਗੇ ਇੱਕ ਹੋਰ ਵੀ ਬਹੁਤ ਵੱਡੀ ਸਮੱਸਿਆ ਆ ਰਹੀ ਸਾਨੂੰ ਐਨ ਜੀ ਓ ਨੂੰ ਜਦੋਂ ਅਸੀਂ ਦਰੱਖਤ ਲਾ ਦਿੰਦੇ ਹਾਂ ਤਾਂ ਉਹਨਾਂ ਦੀ ਸਾਂਭ ਸੰਭਾਲ ਵਾਲਾ ਸਾਡਾ ਪੱਖ ਵੀ ਕਮਜ਼ੋਰ ਰਹਿ ਜਾਂਦਾ ਕਿਉਂਕਿ ਅਸੀਂ ਵੀ ਥਾਂ ਥਾਂ 'ਤੇ ਜਾ ਨਹੀਂ ਸਕਦੇ ਤੁਹਾਨੂੰ ਇਹ ਜਿੰਮੇਵਾਰੀ ਲੈਣੀ ਪਊਗੀ ਵੀ ਤੁਸੀਂ ਜਿਹੜੇ ਪਿੰਡਾਂ 'ਚ ਪਿੰਡ 'ਚ ਅਸੀਂ ਤੁਹਾਡੇ ਦਰੱਖਤ ਲਾਈਏ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਉਹਨਾਂ ਨੂੰ ਪਾਲਣ ਪੋਸ਼ਣ ਦਾ ਕੰਮ ਜਿਹੜਾ ਉਹ ਜ਼ਰੂਰ ਕਰੋ ਤਾਂ ਕਿ ਉਹ ਵਧਣ ਫਲਾ ਵਧ ਫੁੱਲ ਸਕਣ ਤਿੰਨ ਤੋਂ ਪੰਜ ਸਾਲ ਸਾਨੂੰ ਚਾਹੀਦੇ ਹੁੰਦੇ ਇੱਕ ਦਰੱਖਤ ਨੂੰ ਵੱਡਾ ਹੋਣ ਵਾਸਤੇ ਉਹਨੂੰ ਪਾਲਣ ਪੋਸ਼ਣ ਵਾਸਤੇ ਉਸ ਤੋਂ ਬਾਅਦ ਤਾਂ ਉਹਦੀ ਜਿਹੜੀ ਰੂਟੀਨ ਦੇ ਵਿੱਚ ਗੱਲ ਚੱਲਦੀ ਹੈਗੀ ਹੈ ਤਾਂ ਇਹਦੇ ਵਾਸਤੇ ਤੁਸੀਂ ਸਾਨੂੰ ਜ਼ਰੂਰ ਇਹ ਪ੍ਰੋਮਿਸ ਕਰੋ ਵਾਅਦਾ ਕਰੋ ਵੀ ਆਪਾਂ ਇਸ ਗੱਲ ਦੇ ਉੱਤੇ ਚੱਲਾਂਗੇ ਜੀ ਅਤੇ ਇਸ ਗੱਲ ਲਈ ਮੈਂ ਮਤਲਬ ਪੂਰਾ ਪ੍ਰੀਪੇਅਰ ਹੋ ਜਾ ਵੀ ਤੁਸ ਤੁਸੀਂ ਪੂਰਾ ਸਹਿਯੋਗ ਕਰ ਰਹੇ ਹੋ ਆਪਣੇ ਨਾਲ ਦੇ ਸਾਥੀਆਂ ਨਾਲ ਦੋਸਤਾਂ ਨਾਲ ਤੁਸੀਂ ਆਹ ਜਿਹੜੀ ਟੀਮ ਹੈ ਤੁਹਾਡੀ ਨੌਜਵਾਨਾਂ ਦੀ ਜਾਂ ਪੰਚਾਇਤ ਆ ਤੁਸੀਂ ਉਹਦੀ ਉਹਦੀ ਬੰਨੀਓ ਪੂਰੀ ਤਿਆਰੀ ਕਰਕੇ ਰੱਖੋ ਅਤੇ ਆਪਾਂ ਦੋ ਚਾਰ ਦਿਨਾਂ ਦੇ ਵਿੱਚ ਹੀ ਇਸ ਪਿੰਡ 'ਚ ਆ ਕੇ ਅਸੀਂ ਨਾ ਐਨ ਜੀ ਓ ਵੱਲੋਂ ਅਤੇ ਆਪਾਂ ਮੀਟਿੰਗ ਕਰਾਂਗੇ ਅਤੇ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਤਸ਼ਾਹਿਤ ਕਰੀਏ ਅਤੇ ਤਾਂ ਕਿ ਉਹ ਇਸ ਪਾਸੇ ਆ ਸਕਣ ਕਿਉਂਕਿ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈਗੀ ਹੈ ਅਤੇ ਮੈਨੂੰ ਲੱਗਦਾ ਕਿ ਤੁਹਾਡੀ ਗੱਲਬਾਤ ਤੋਂ ਕਿ ਤੁਸੀਂ ਉਤਸ਼ਾਹਿਤ ਨੌਜਵਾਨ ਹੋ ਅਤੇ ਉਮੀਦ ਕਰਦਾ ਵੀ ਤੁਸੀਂ ਵਧੀਆ ਤਰੀਕੇ ਨਾਲ ਸਾਨੂੰ ਸਹਿਯੋਗ ਕਰੋਗੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਸਾਨੂੰ ਕੋਪਰੇਟ ਕੀਤਾ ਹੈਗਾ ਅਤੇ ਇਸ ਤੋਂ ਬਾਅਦ ਆਪਾਂ ਜਦੋਂ ਇਸ ਇਸ ਵਿਸ਼ੇ ਦੇ ਉੱਤੇ ਚੱਲਾਂਗੇ ਤਾਂ ਹੋਰ ਵੀ ਬਹੁਤ ਸਾਰੇ ਮੁੱਦੇ ਹੈਗੇ ਨਸ਼ਿਆਂ ਦਾ ਮੁੱਦਾ ਹੈਗਾ ਹੋਰ ਬਹੁਤ ਸਾਰੇ ਮੁੱਦੇ ਆ ਜਦੋਂ ਆਪਾਂ ਦਰੱਖਤਾਂ ਵਾਲੇ ਪਾਸੇ ਤੁਰਾਂਗੇ ਤਾਂ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਵੀ ਛੂਵਾਂਗੇ ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਉਮੀਦ ਕਰਦਾ ਵੀ ਜਿਹੜੀ ਤੁਹਾਡਾ ਜਿਹੜੀ ਪੰਚਾਇਤ ਹੈਗੀ ਤੁਹਾਡੀ ਨੌਜਵਾਨ ਸਭਾ ਹੈਗੀ ਹੈ ਉਹ ਸਾਡੀ ਐਨ ਜੀ ਓ ਨੂੰ ਸਹਿਯੋਗ ਕਰੂਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਓਕੇ ਜੀ ਥੈਂ ਅਤੇ ਓਕੇ ਜੀ ਥੈਂਕ ਯੂ